ਜੀ ਹਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਟੈਕਨੋਲੋਜੀ ਨੇ ਬੈਂਕਿੰਗ ਨੂੰ ਬਹੁਤ ਹੀ ਆਸਾਨ ਬਣਾ ਲਿਆ ਹੈ ਅੱਜ ਕੱਲ੍ਹ ਸਾਨੂੰ ਬੈਂਕ ਜਾਣ ਦੀ ਲੋੜ ਨਹੀਂ ਪੈਂਦੀ ਅਸੀਂ ਆਪਣੇ ਪੈਸੇ ਏਟੀਐਮ ਰਾਹੀਂ ਹੀ ਕਢਵਾ ਲੈਂਦੇ ਹਨ ਪਹਿਲਾਂ ਇਹ ਹੁੰਦਾ ਸੀ ਕਿ ਸਾਨੂੰ ਬੜੀ ਲੰਬੀ ਲੰਬੀ ਲਾਈਨਾਂ ਵਿੱਚ ਬੈਂਕਾਂ ਵਿੱਚ ਜਾ ਕੇ ਪੈਸੇ ਕਢਾਉਨੇ ਪੈਂਦੇ ਸਨ ਅਤੇ ਜਮ੍ਹਾਂ ਕਰਾਉਨੇ ਪੈਂਦੇ ਸਨ ਪਰ ਅੱਜ ਕੱਲ੍ਹ ਅਸੀਂ ਇਹ ਕੰਮ ਆਪਣੇ ਏਟੀਐਮ ਰਾਹੀਂ ਬਹੁਤ ਹੀ ਆਸਾਨੀ ਨਾਲ ਕਰ ਲੈਂਦੇ ਹਨ ਅੱਜ ਕੱਲ੍ਹ ਇਕ ਹੋਰ ਐਪ ਵੀ ਚੱਲ ਗਈ ਹੈ ਜਿਹਦਾ ਨਾਂ ਗੂਗਲ ਪੇ ਹੈ ਗੂਗਲ ਪੇ ਰਾਹੀਂ ਵੀ ਅਸੀਂ ਆਪਣੇ ਫੋਨ ਤੋਂ ਆਨਲਾਈਨ ਪੈਸੇ ਭੇਜ ਭੇਜ ਅਤੇ ਮੰਗਾ ਮੰਗਵਾ ਸਕਦੇ ਹਨ ਤੇ ਇਸ ਰਾਹੀਂ ਸਾਡਾ ਬਹੁਤ ਹੀ ਕੰਮ ਆਸਾਨ ਹੋ ਗਿਆ ਹੈ ਪਰ ਇਸ ਦੇ ਨਾਲ ਨਾਲ ਬਹੁਤ ਹੀ ਫਰੋਡ ਦੀ ਵੀ ਗਿਣਤੀ ਵੱਧਦੀ ਜਾ ਰਹੀ ਹੈ ਅੱਜ ਕੱਲ੍ਹ ਲੋਕੀ ਆਨਲਾਈਨ ਫਰੋਡ ਲਿੰਕ ਭੇਜ ਕੇ ਸਾਡੇ ਕੋਲ ਪੈਸੇ ਠੱਗ ਲੈਂਦੇ ਹਨ ਜੇ ਕਿਸੇ ਅਨਪੜ੍ਹ ਬੰਦਾ ਇਹਨਾਂ ਲਿੰਕਾਂ ਉੱਤੇ ਕਲਿੱਕ ਕਰ ਦਿੰਦਾ ਹੈ ਤਾਂ ਉਹਦੇ ਬੈਂਕ ਦੇ ਵਿੱਚ ਸਾਰੇ ਪੈਸੇ ਸਾਫ ਹੋ ਜਾਂਦੇ ਹਨ ਇਹ ਪੈਸੇ ਸਾਫ ਹੋਣ ਕਾਰਨ ਬਹੁਤ ਹੀ ਉਹਨਾਂ ਨੂੰ ਦੁੱਖ ਲੱਗਦਾ ਹੈ ਇੱਕ ਇਸ ਘਾਟ ਨੇ ਸਾਨੂੰ ਬਹੁਤ ਵੱਡੀ ਉਲਝਣ ਵਿੱਚ ਵੀ ਪਾ ਦਿੱਤਾ ਹੈ ਸਾਨੂੰ ਪੜ੍ਹੇ ਲਿਖੇ ਬੰਦਿਆਂ ਨੂੰ ਇਹਨਾਂ ਤੋਂ ਬਚ ਬਚ ਸਕਦਾ ਹੈ ਪਰ ਜੇ ਬੰਦਾ ਥੋੜ੍ਹਾ ਘੱਟ ਪੜ੍ਹਿਆ ਹੈ ਅਤੇ ਉਹਨੂੰ ਇੰਨੀ ਸਮਝ ਨਹੀਂ ਹੈਗੀ ਤਾਂ ਉਹ ਇਹਨਾਂ ਫਰੋਡ ਕੋਲਾਂ ਦਾ ਸ਼ਿਕਾਰ ਹੋ ਜਾਂਦਾ ਹੈ ਧੰਨਵਾਦ